ਬੱਤੀ ਦੀ ਗੱਲ ਕਰੀਏ ਜੀ ਅਤੇ ਬੱਤੀ ਕਿੰਨੇ ਘੰਟੇ ਆਉਂਦੀ ਹੈ ਅਤੇ ਕਿੰਨੇ ਘੰਟੇ ਨਹੀਂ ਆਉਂਦੀ ਇਹ ਤਾਂ ਮੌਸਮ 'ਤੇ ਡਿਪੈਂਡ ਕਰਦਾ ਹੈ ਜੀ ਗਰਮੀਆਂ ਵਿੱਚ ਕੱਟ ਜ਼ਿਆਦਾ ਲੱਗਦੇ ਹਨ ਅਤੇ ਸਰਦੀਆਂ ਵਿੱਚ ਕੱਟ ਘੱਟ ਲੱਗਦੇ ਹਨ ਕਾਰਨ ਇਹੀ ਹੈ ਕਿ ਗਰਮੀਆਂ ਵਿੱਚ ਖਪਤ ਜ਼ਿਆਦਾ ਹੁੰਦੀ ਹੈ ਸਭ ਲੋਕਾਂ ਨੂੰ ਬੱਤੀ ਦੀ ਜ਼ਿਆਦਾ ਲੋੜ ਹੁੰਦੀ ਹੈ ਪੱਖੇ ਚੱਲਣੇ ਫਰਿੱਜ਼ਾਂ ਜ਼ਿਆਦਾ ਚੱਲਣੀਆਂ ਕੈਂਡੀਆਂ ਚੱਲਣੀਆਂ ਏ ਸੀ ਚੱਲਣੇ ਬੜਾ ਕੁਛ ਹੁੰਦਾ ਜੀ ਉਹ ਸਾਰਾ ਗਰਮੀਆਂ 'ਚ ਖਪਤ ਜ਼ਿਆਦਾ ਹੁੰਦੀ ਹੈ ਉਦੋਂ ਕੱਟ ਵੀ ਜ਼ਿਆਦਾ ਲੱਗਦੇ ਹੈ ਸਰਦੀਆਂ ਵਿੱਚ ਕੱਟ ਘੱਟ ਲੱਗਦੇ ਹਨ ਕਿਉਂਕਿ ਸਰਦੀਆਂ 'ਚ ਖਪਤ ਵੀ ਘੱਟ ਹੁੰਦੀ ਹੈ ਅਤੇ ਕੱਟ ਜਿਹੜੇ ਲੱਗਦੇ ਹੈ ਉਹ ਬਾਰਿਸ਼ਾਂ ਦੇ ਮੌਸਮ 'ਚ ਵੀ ਬਹੁਤ ਲੱਗਦੇ ਹੈ ਉਹਦਾ ਕਾਰਨ ਹੈ ਕਿ ਬਾਰਿਸ਼ਾਂ ਵਿੱਚ ਇੱਕ ਕਾਰਨ ਹੁੰਦਾ ਜੀ ਸ਼ੋਰਟ ਸਰਕਟ ਨਾ ਹੋ ਜਾਵੇ ਖੰਭੇ ਨਾ ਡਿੱਗ ਜਾਣ ਜਿਹਦੇ ਕਰਕੇ ਮੌਸਮ ਖਰਾਬ ਹੋਣ ਦੇ ਨਾਲ ਨਾਲੋਂ ਨਾਲ ਹੀ ਕੱਟ ਲੱਗ ਜਾਂਦੇ ਆ ਬੱਤੀ ਬੰਦ ਹੋ ਜਾਂਦੀ ਹੈ ਜੀ ਬਾਰਿਸ਼ ਆ ਗਈ ਲਾਈਟ ਬੰਦ ਅਤੇ ਕੱਟ ਦੇ ਕਾਰਨ ਇੱਕ ਆਮ ਬੰਦੇ ਦੀ ਜ਼ਿੰਦਗੀ ਬਹੁਤ ਪ੍ਰਭਾਵਿਤ ਹੁੰਦੀ ਆ ਕਿਉਂਕਿ ਅੱਜ ਕੱਲ੍ਹ ਸਾਰੇ ਕੰਮ ਜਿਹੜੇ ਹੈ ਬੱਤੀ ਦੇ ਨਾਲ ਹੀ ਚੱਲਦੇ ਆ ਪੱਖੇ ਲੈ ਲਉ ਮਿਕਸੀਆਂ ਲੈ ਲਉ ਫਰਿੱਜ ਲੈ ਲਉ ਏ ਸੀ ਸਭ ਕੁਛ ਬੱਤੀ ਦੇ ਨਾਲ ਹੀ ਚੱਲਦਾ ਬੱਤੀ ਨਾ ਹੋਣ ਕਰਕੇ ਘਰ ਦੇ ਸਾਰੇ ਕੰਮ ਠੱਪ ਹੋ ਜਾਂਦੇ ਆ ਗਰਮੀਆਂ ਦੇ ਵਿੱਚ ਜੇ ਬੱਤੀ ਬੰਦ ਹੋ ਜਾਵੇ ਤਾਂ ਬਹੁਤਾ ਜ਼ਿਆਦਾ ਔਖਾ ਹੁੰਦਾ ਹੈ ਇੱਕ ਬੱਚੇ ਸਕੂਲੋਂ ਆਉਣ ਵੱਡੇ ਨੌਕਰੀਆਂ ਤੋਂ ਥੱਕੇ ਹਾਰੇ ਘਰ ਆਉਣ ਆਉਂਦਿਆ ਕੱਟ ਲੱਗਾ ਹੋਵੇ ਇੱਕ ਤਾਂ ਗਰਮੀ 'ਚ ਬਾਹਰੋਂ ਬੰਦਾ ਬੇਹਾਲ ਹੋ ਜਾਵੇ ਇੱਕ ਘਰ ਆ ਕੇ ਏ ਸੀ ਨਾ ਚੱਲਣ ਚਲੋ ਅੱਜ ਕੱਲ੍ਹ ਇਨਵਰਟਰ ਤਾਂ ਤਕਰੀਬਨ ਹਰ ਘਰ 'ਚ ਲੱਗੇ ਆ ਪਰ ਇਨਵਰਟਰ ਵੀ ਕਿੰਨੀ ਕੁ ਦੇਰ ਚੱਲ ਜਾਵੇਗਾ ਆਖਰ ਤਾਂ ਉਹਨੇ ਵੀ ਬੰਦ ਹੋਣਾ ਲੰਬੇ ਕੱਟਾਂ ਦੇ ਨਾਲ ਇਨਵਰਟਰ ਵੀ ਖਰਾਬ ਹੋ ਜਾਂਦੇ ਹੈ ਡੈਡ ਹੋ ਜਾਂਦੇ ਹੈ ਫਿਰ ਗਰਮੀ 'ਚ ਬੈਠੋ ਫਿਰ ਉਹਦੇ ਨਾਲ ਪੱਖਾ ਚੱਲੇਗਾ ਏ ਸੀ ਨਹੀਂ ਚੱਲੇਗਾ ਫਰਿੱਜ ਨਹੀਂ ਚੱਲੇਗਾ ਹੋਰ ਜਿਹੜੇ ਬੱਤੀ ਨਾਲ ਚੱਲਣ ਵਾਲੀਆਂ ਮਸ਼ੀਨਾਂ ਨੇ ਉਹ ਨਹੀਂ ਚੱਲਣਗੀਆਂ ਕਾਰਖਾਨੇ ਬੰਦ ਹੋ ਜਾਣਗੇ ਕਾਰਖਾਨਿਆਂ 'ਚ ਕੰਮ ਘੱਟ ਹੋਏਗਾ ਲੇਬਰ ਵਿਹਲੀ ਬਹਿ ਜਾਵੇਗੀ ਲੇਬਰ ਨੂੰ ਪੈਸੇ ਦੇਣੇ ਪੈਂਦੇ ਪੂਰੇ ਕੰਮ ਹੁੰਦਾ ਨਹੀਂ ਉਹ 'ਤੇ ਇਫੈਕਟ ਪੈਂਦਾ ਘਰੇਲੂ ਜੀਵਨ 'ਤੇ ਇਫੈਕਟ ਪੈਂਦਾ ਬੱਚਿਆਂ ਦੀ ਪੜ੍ਹਾਈਆਂ 'ਤੇ ਇਫੈਕਟ ਪੈਂਦਾ ਬੱਤੀ ਨਾ ਹੋਣ ਕਰਕੇ ਬੱਚੇ ਸਹੀ ਤਰੀਕੇ ਨਾਲ ਪੜ੍ਹ ਨਹੀਂ ਪਾਉਂਦੇ ਇਹਦੇ ਮੁਕਾਬਲੇ ਸਰਦੀਆਂ ਵਿੱਚ ਅਗਰ ਕੱਟ ਲੱਗਦੇ ਹੈ ਤਾਂ ਉਹਦਾ ਘੱਟ ਫਰਕ ਪੈਂਦਾ ਫਰਕ ਤਾਂ ਉਹਦੇ ਨਾਲ ਵੀ ਪਵੇਗਾ ਕਿਉਂਕਿ ਬਲੋਰ ਨਹੀਂ ਚੱਲਦੇ ਲਾਈਟਾਂ ਅੰਦਰ ਬੈਠਣਾ ਹੁੰਦਾ ਹੈ ਬਾਹਰ ਬੈਠ ਨਹੀਂ ਸਕਦੇ ਅੰਦਰ ਕਮਰਿਆਂ 'ਚ ਵੜ ਕੇ ਬੈਠਾਂਗੇ ਲਾਈਟ ਨਹੀਂ ਹੋਏਗੀ ਤਾਂ ਹਨੇਰ੍ਹਾ ਹੋ ਜਾਵੇਗਾ ਬੱਤੀ ਤਾਂ ਜ਼ਰੂਰ ਚਾਹੀਦੀ ਹੈ ਪਰ ਗਰਮੀ ਨਾਲੋਂ ਥੋੜ੍ਹਾ ਰਾਹਤ ਘੱਟ ਹੁੰਦੀ ਹੈ ਬਾਰਿਸ਼ ਦੇ ਮੌਸਮ ਵਿੱਚ ਵੀ ਕੱਟ ਲੱਗਣ ਦੇ ਨਾਲ ਨੁਕਸਾਨ ਤਾਂ ਹੈ ਹੀ ਹੈ ਬਾਰਿਸ਼ 'ਚ ਤਾਂ ਬੰਦਾ ਬਾਹਰ ਵੀ ਨਹੀਂ ਬੈਠ ਸਕਦਾ ਅੰਦਰ ਵੜਾਂਗੇ ਤਾਂ ਸਾਨੂੰ ਲਾਈਟ ਚਾਹੀਦੀ ਹੈ ਸਰਦੀਆਂ ਵਿੱਚ ਅਸੀਂ ਚਲੋ ਅੰਦਰ ਵੜ ਕੇ ਬੈਠਾਂਗੇ ਫੇਰ ਗਰਮੀਆਂ 'ਚ ਅਸੀਂ ਬਾਹਰ ਮਜ਼ਾ ਲੈ ਸਕਦੇ ਹਾਂ ਬਾਰਿਸ਼ ਦਾ ਉਦੋਂ ਤੰਗੀ ਘੱਟ ਹੋਏਗੀ ਪਰ ਜਦਕਿ ਜਿਹੜੀ ਗਰਮੀਆਂ ਵਿੱਚ ਤੰਗੀ ਬਹੁਤ ਆ ਬਾਰਿਸ਼ 'ਚ ਤੰਗੀ ਬਹੁਤ ਆ ਕਿਉਂਕਿ ਬਾਰਿਸ਼ ਅਸੀਂ ਬਾਹਰ ਬਾਰਿਸ਼ ਵਿੱਚ ਬੈਠ ਨਹੀਂ ਸਕਦੇ ਬਾਰਿਸ਼ ਨੂੰ ਕੋਲ ਬੈਠ ਕੇ ਇੰਜੋਏ ਕਰਾਂਗੇ ਪਰ ਬਾਰਿਸ਼ 'ਚ ਬੈਠ ਨਹੀਂ ਸਕਦੇ ਨਾ ਇਸ ਲਈ ਬੱਤੀ ਤਾਂ ਸਾਨੂੰ ਅੰਦਰ ਵੜ ਕੇ ਜੇ ਬਹਿਣਾ ਹੈ ਤਾਂ ਬੱਤੀ ਤਾਂ ਜ਼ਰੂਰ ਚਾਹੀਦੀ ਹੈ ਇਸ ਲਈ ਬੱਤੀ ਦੇ ਨਾ ਹੋਣ ਨਾਲ ਬਿਜਲੀ ਜਾਣ ਦੇ ਨਾਲ ਆਮ ਜ਼ਿੰਦਗੀ ਬਹੁਤ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ ਔਰ ਜ਼ਿੰਦਗੀ ਵਿੱਚ ਬੱਤੀ ਘੱਟ ਤੋਂ ਘੱਟ ਜਾਵੇ ਤਾਂ ਜ਼ਿੰਦਗੀ ਦਾ ਆਨੰਦ ਹੀ ਕੁਛ ਹੋਰ ਹੈ